ਸਰਕਾਰ ਪਰੀ ਸਰਕਾਰ ਪੰਜਾਬ ਵਿੱਚ ਰਾਜਨੀਤਿਕ ਪ੍ਰਣਾਲੀਆਂ ਸਿਆਸਤਦਾਨਾਂ ਜਾਂ ਅਧਿਕਾਰੀਆਂ ਵਿੱਚ ਹਿੱਤਾਂ ਦੇ ਟਕਰਾਅ ਜਾਂ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਇੱਦਾਂ ਹੱਲ ਕਰਦੀ ਹੈ ਸਭ ਤੋਂ ਪਹਿਲਾਂ ਉਹ ਇਨਵੈਸਟੀਗੇਸ਼ਨ ਕਰਦੀ ਹੈ ਜਾਂਚ ਪੜਤਾਲ ਕਰਦੀ ਏ ਕਿ ਕਿੱਥੇ ਕਿੱਥੇ ਕੀ ਕੀ ਚੱਲ ਰਿਹਾ ਹੈ ਕਿੱਥੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਕਿੱਥੇ ਉਹਨਾਂ ਦੇ ਹਿੱਤ ਦਾ ਕਤਲ ਹੋ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਇਹ ਇਨਵੈਸਟੀਗੇਸ਼ਨ ਹੁੰਦੀ ਹੈ ਫਿਰ ਉਸ ਤੋਂ ਬਾਅਦ ਇਹਨੂੰ ਸਹੀ ਕਰਨ ਵਾਸਤੇ ਟਰਾਂਸਪਰੈਂਸੀ ਟਰਾਂਸਪੇਰੈਂਸੀ ਲੈ ਕੇ ਆਉਂਦੀ ਲੈ ਕੇ ਆਈ ਜਾਂਦੀ ਹੈ ਇਹਦੇ ਵਿੱਚ ਠੀਕ ਹੈ ਤਾਂ ਜੋ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਲੱਗੇ ਵੀ ਸਰਕਾਰ ਕੀ ਕੀ ਕਰ ਰਹੀ ਹੈ ਅਤੇ ਭ੍ਰਿਸ਼ਟਾਚਾਰ ਕਿੱਥੇ ਕਿੱਥੇ ਚੱਲ ਰਿਹਾ ਅਤੇ ਇਹਨੂੰ ਕਿੱਦਾਂ ਕਿੱਦਾਂ ਖਤਮ ਅਸੀਂ ਕਰ ਰਹੇ ਹਾਂ ਕਿਉਂਕਿ ਇਹਦੇ ਵਿੱਚ ਇੱਕ ਵੱਡੇ ਤੋਂ ਵੱਡਾ ਅਤੇ ਛੋਟੇ ਤੋਂ ਛੋਟਾ ਜਿਹੜਾ ਕਰਮਚਾਰੀ ਵਿੱਚ ਸ਼ਾਮਿਲ ਹੁੰਦਾ ਭ੍ਰਿਸ਼ਟਾਚਾਰ ਦੇ ਵਿੱਚ ਠੀਕ ਆ ਅਤੇ ਸਰਕਾਰ ਇਨਵੈਸਟੀਗੇਸ਼ਨ ਕਰਕੇ ਸਭ ਤੋਂ ਪਹਿਲਾਂ ਇਨਵੈਸਟੀਗੇਸ਼ਨ ਆਫ ਮੈਟਰ ਭ੍ਰਿਸ਼ਟਾਚਾਰ ਵਿਰੋਧੀ ਏਜੰਸੀਆਂ ਇਹ ਚੀਜ਼ਾਂ ਇਨਵੈਸਟੀਗੇਸ਼ਨ ਕਰਕੇ ਹੀ ਉਸ ਤੋਂ ਬਾਅਦ ਟਰਾਂਸਪਰੈਂਸੀ ਲੈ ਕੇ ਆਉਂਦੀਆ ਓਕੇ ਧੰਨਵਾਦ